ਹਾਂ ਮੈਂ ਵੀਡੀਓ ਗੇਮ ਬਾਰੇ ਬਹੁਤ ਕੁਝ ਜਾਣਦੀ ਹਾਂ ਇਹੋ ਜਿਹਾ ਕੋਈ ਵੀ ਵਿਅਕਤੀ ਨਹੀਂ ਹੈ ਜਿਸ ਨੂੰ ਵੀਡੀਓ ਗੇਮਾਂ ਬਾਰੇ ਨਾ ਪਤਾ ਹੋਵੇ ਮੈਂ ਕਾਫੀ ਸਾਰੀਆਂ ਵੀਡੀਓ ਗੇਮਾਂ ਖੇਡੀਆਂ ਹਨ ਜਿਸ ਦੇ ਵਿੱਚ ਪੱਬਜੀ ਅਤੇ ਕਾਫੀ ਸਾਰੀ ਹੋਰ ਗੇਮਾਂ ਵੀ ਆ ਜਾਂਦੀਆਂ ਹਨ ਜਿਵੇਂ ਕਿ ਟੈਂਪਲ ਰੰਨ ਬਬਲ ਸ਼ੂਟਰ ਐਂਗਰੀ ਬਰਡ ਅਤੇ ਹੋਰ ਵੀ ਬਹੁਤ ਸਾਰੀ ਗੇਮਾਂ ਹਨ ਕੁਝ ਕੰਪਿਊਟਰ 'ਤੇ ਖੇਡਣ ਵਾਲੀ ਹੁੰਦੀਆਂ ਹਨ ਕੁਛ ਮੋਬਾਇਲ 'ਤੇ ਪਰ ਮੈਨੂੰ ਕਾਫੀ ਜ਼ਿਆਦਾ ਪਸੰਦ ਕੰਪਿਊਟਰ 'ਤੇ ਹਨ ਮੈਨੂੰ ਵੀਡੀਓ ਗੇਮਜ਼ ਕੰਪਿਊਟਰ 'ਤੇ ਖੇਡਣਾ ਬਹੁਤ ਜ਼ਿਆਦਾ ਪਸੰਦ ਹੈ ਹੈ ਜਿਵੇਂ ਕਿ ਪੱਬਜੀ ਨੂੰ ਫੋਨ 'ਤੇ ਵੀ ਖੇਡਿਆ ਜਾ ਸਕਦਾ ਹੈ

ਕੌਲ ਆਫ ਡਿਊਟੀ ਵੀ ਪੱਬਜੀ ਵਰਗੀ ਇੱਕ ਗੇਮ ਹੈ ਜਿਸ ਨੂੰ ਅਸੀਂ ਕੰਪਿਊਟਰ 'ਤੇ ਵੀ ਖੇਡ ਸਕਦੇ ਹਨ ਅਤੇ ਮੋਬਾਇਲ ਵਿੱਚ ਵੀ ਪਰ ਮੈਨੂੰ ਸਭ ਤੋਂ ਜ਼ਿਆਦਾ ਵੈਲੋਰੈਂਟ ਪਸੰਦ ਹੈ ਇਹ ਗੇਮ ਰਾਅਟ ਦੀ ਗੇਮ ਹੈ ਇਹ ਗੇਮ ਅੱਜ ਕੱਲ੍ਹ ਕਾਫੀ ਜ਼ਿਆਦਾ ਪਾਪੂਲਰ ਹੈ ਆਪਣੇ ਲੋਕਾਂ ਦੇ ਵਿੱਚ